ਗਲਾਸ ਕੜਛੀ ਚਮਚ ਕੁੱਕਰ ਪਤੀਲਾ ਕੜਾਹੀ ਪਲੇਟ ਪਰਾਤ ਤਵਾ ਚਕਲਾ ਵੇਲਨਾ ਫਰਾਈ ਪੈਨ ਦੁੱਧ ਉਬਾਲਣ ਵਾਲਾ ਪਤੀਲਾ ਕੁੱਕਰ ਕੁੱਕਰ ਦੇ ਵਿੱਚ ਅਸੀਂ ਸਬਜ਼ੀ ਬਣਾਉਂਦੇ ਹਾਂ ਸਾਗ ਬਣਾਉਂਦੇ ਹਾਂ ਆਲੂ ਉਬਾਲਦੇ ਹਾਂ ਦਾਲ ਬਣਾਉਂਦੇ ਹਾਂ ਔਰ ਕੜਾਹੀ ਦੇ ਵਿੱਚ ਅਸੀਂ ਖੀਰ ਬਣਾ ਲੈਂਦੇ ਹਾਂ ਅਸੀਂ ਸਾਗ ਵੀ ਉਹ ਤੜਕਾ ਲਗਾਉਂਦੇ ਹਾਂ ਔਰ ਕੜਾਹ ਵੀ ਬਣਾ ਲੈਂਦੇ ਹਾਂ ਔਰ ਪਲੇਟ ਦੇ ਵਿੱਚ ਅਸੀਂ ਰੋਟੀ ਖਾਂਦੇ ਹਾਂ ਸਟੀਲ ਦੇ ਗਲਾਸ ਵਿੱਚ ਅਸੀਂ ਠੰਡਾ ਪਾਣੀ ਪੀ ਸਕਦੇ ਹਾਂ ਕੰਚ ਦੇ ਗਲਾਸ ਉਹ ਸਾਡੇ ਲਈ ਕੋਲਡ ਡ੍ਰਿੰਕ ਵਾਸਤੇ ਵਰਤੋਂ ਵਿੱਚ ਆਉਂਦੇ ਹਨ ਚਮਚ ਅਸੀਂ ਚਾਵਲ ਖਾਣ ਵਾਸਤੇ ਯੂਜ ਕਰਦੇ ਹਾਂ ਔਰ ਕੜਛੀ ਸਬਜ਼ੀ ਬਣਾਉਣ ਵਾਸਤੇ ਵਰਤੋਂ ਵਿੱਚ ਆਉਂਦੀ ਹੈ ਪਰਾਤ ਵਿੱਚ ਅਸੀਂ ਆਟਾ ਗੁੰਨਦੇ ਹਾਂ ਪੰਜੀਰੀ ਬਣਾ ਲੈਂਦੇ ਹਾਂ ਆਲੂ ਕੁੱਕਰ ਦੇ ਵਿੱਚ ਅਸੀਂ ਉਬਾਲ ਸਕਦੇ ਹਾਂ ਔਰ ਕੜਾਹੀ ਦੇ ਵਿੱਚ ਅਸੀਂ ਸਬਜ਼ੀ ਤੜਕਾ ਲਗਾ ਲੈਂਦੇ ਹਾਂ ਬਣਾ ਲੈਂਦੇ ਹਾਂ ਔਰ ਡੋਂਗਾਂ ਵਿੱਚ ਅਸੀਂ ਆਟਾ ਗੁੰਨ ਕੇ ਰੱਖ ਸਕਦੇ ਹਾਂ ਬਚੀ ਹੋਈ ਸਬਜ਼ੀ ਅਸੀਂ ਰੱਖ ਸਕਦੇ ਹਾਂ ਔਰ ਫਰਾਈ ਪੈਨ ਦੇ ਵਿੱਚ ਅਸੀਂ ਚਾਹ ਬਣਾ ਲੈਂਦੇ ਹਾਂ ਦੁੱਧ ਉਬਾਲ ਲੈਂਦੇ ਹਾਂ ਔਰ ਕੌਫੀ ਬਣਾ ਲੈਂਦੇ ਹਾਂ ਅਸੀਂ ਧੰਨਵਾਦ